ਫਰਨੀਚਰ ਸ਼ੋਪ ਤੋਂ ਬੋਲਦੇ ਜੀ ਅ ਮੈਮ ਮੈਂ ਨਾ ਆਪਣੇ ਮਤਲਬ ਮੇਰੇ ਮੈਰਿਜ ਦਾ ਸਾਰਾ ਸਮਾਨ ਸੀ ਨਾ ਉਹਨੂੰ ਰੀਨਿਊ ਕਰਵਾਉਣਾ ਹੈ ਦੁਬਾਰਾ ਸੈੱਟ ਕਰਵਾਉਣਾ ਥੋੜ੍ਹਾ ਖ਼ਰਾਬ ਹੋ ਗਿਆ ਸੀ ਅਤੇ ਕਿੰਨਾ ਕੁ ਖ਼ਰਚਾ ਆ ਜੂਗਾ ਬੈੱਡ ਹੈਗਾ ਇਆ ਸੋਫ਼ੇ ਹੈਗੇ ਆ ਔਰ ਡਰੈਸਿੰਗ ਟੇਬਲ ਹੈ ਜਿੱਦਾਂ ਹਾਂਜੀ ਹਾਂਜੀ ਉਹ ਥੋੜ੍ਹੇ ਪੁਰਾਣੇ ਸਟਾਈਲ ਦਾ ਹੈ ਅਤੇ ਮੈਂ ਕਿਹਾ ਥੋੜ੍ਹਾ ਨਵੇਂ ਸਟਾਈਲ ਦਾ ਬਣਵਾ ਲੈਂਦੇ ਹਾਂ ਨਹੀਂ ਫਿਰ ਉਹ ਨਾ ਤੁਹਾਨੂੰ ਪਤਾ ਪੁਰਾਣੇ ਜਮਾਨੇ ਦੀ ਲੱਕੜ ਥੋੜ੍ਹੀ ਮਜ਼ਬੂਤ ਹੁੰਦੀ ਹੈ ਥੋੜ੍ਹੇ ਪੁਰਾਣੇ ਟਾਈਮ ਦੀਆਂ ਚੀਜ਼ਾਂ ਜਿਹੜੀਆਂ ਅਤੇ ਮੈਂ ਉਹ ਨੂੰ ਹੀ ਰਿਨਿਊ ਕਰਵਾਉਣਾ ਹੈ ਥੋੜ੍ਹਾ ਉਹ ਯਾਦਗਾਰ ਜਿਹੀ ਹੁੰਦੀ ਹੈ ਨਾ ਆਪਣੀ ਮੈਰਿਜ ਦੀ ਇਸ ਕਰਕੇ ਹਾਂਜੀ ਕੋਈ ਨਹੀਂ ਤੁਸੀਂ ਮੈਨੂੰ ਦੱਸ ਦਿਓ ਕਿੰਨਾ ਕੁ ਖ਼ਰਚਾ ਆ ਜੂਗਾ ਔਰ ਮਤਲਬ ਘਰ ਕਰੋਂਗੇ ਜਾਂ ਉੱਥੇ ਮਤਲਬ ਅਸੀਂ ਭਿਜਵਾਈਏ ਫਰਨੀਚਰ ਅ ਹਾਂ ਹੈਗੀ

ਠੀਕ ਹੈ ਹਾਂਜੀ ਹਾਂਜੀ ਅਤੇ ਉਹ ਮਤਲਬ ਸਮਾਨ ਵਗੈਰਾ ਤੁਸੀਂ ਆਪਣਾ ਲਗਾਓਂਗੇ ਆਪਣਾ ਹੀ ਆਵੇਗਾ ਤੁਸੀਂ ਇੱਕ ਵਾਰੀ ਹੈ ਆ ਕਿ ਨਾ ਇੱਕ ਵਾਰ ਚੈੱਕ ਕਰ ਲਿਓ ਕਿੱਦਾਂ ਦਾ ਹੈਗਾ ਅਤੇ ਫਿਰ ਉਸ ਹਿਸਾਬ ਨਾਲ ਅਸੀਂ ਵੀ ਸ਼ੋਪ 'ਤੇ ਆ ਕੇ ਚੈੱਕ ਕਰ ਲਾਂਗੇ ਸਾਰਾ ਤੁਹਾਡਾ ਸਮਾਨ ਜੋ ਵੀ ਸਨਮਾਈਕਾ ਵਗੈਰਾ ਠੀਕ ਹੈ ਹਾਂਜੀ ਹਾਂਜੀ ਠੀਕ ਹੈ ਪ੍ਰਾਈਜ਼ ਵਗੈਰਾ ਕੀ ਹੋਵੇਗਾ ਪ੍ਰਾਈਜ਼ ਕੀ ਹੋਵੇਗਾ ਹਾਂਜੀ ਹਾਂਜੀ ਠੀਕ ਹੈ ਔਰ ਇੱਕ ਮੇਰੇ ਕੋਲ ਟੇਬਲ ਵੀ ਹੈਗਾ ਉਹ ਨਾ ਸ਼ੀਸ਼ਾ ਵਿਚਾਰਾ ਨੀਚੇ ਵਾਲੀ ਚੀਜ਼ ਟੁੱਟ ਗਈ ਅਤੇ ਉਹ ਸ਼ੀਸ਼ਾ ਮੈਂ ਨਾ ਫਿੱਟ ਕਰਵਾਉਣਾ ਵਿੱਚ ਟੇਬਲ ਦੇ ਸਾਇਡਾਂ ਵੀ ਕਵਰ ਹੋਣੀਆਂ ਚਾਹੀਦੀਆਂ ਹਾਂਜੀ ਸ਼ੀਸ਼ਾ ਮੇਰੇ ਕੋਲ ਪਿਆ ਵਾ ਮੀਰਰ ਉਹਦਾ ਉੱਪਰ ਵਾਲਾ ਨੀਚੇ ਵਾਲਾ ਸਾਰਾ ਪੂਰਾ ਨਾ ਟੇਬਲ ਨਿਊ ਲੁੱਕ ਦਾ ਬਣਾਉਣਾ ਹੈ ਉਹ ਵੀ ਹਾਂਜੀ ਕਿੱਥੇ ਹੈ ਜੀ ਇਹ ਤੁਹਾਡੀ ਦੁਕਾਨ ਮੈਂ ਐੱਡ ਦੇਖੀ ਸੀ ਤੁਹਾਡੀ ਹੈ ਨਾ ਫੇਸਬੁੱਕ 'ਤੇ ਜਿੱਦਾਂ

ਠੀਕ ਹੈ ਹਾਂਜੀ ਅਤੇ ਉਹ ਮਤਲਬ ਸ਼ੋਪ ਤੁਹਾਡੀ ਕਿਸ ਨਾਮ 'ਤੇ ਹੈ ਅਤੇ ਮੈਨੂੰ ਪਤਾ ਲੱਗ ਜੇਗਾ ਫਿਰ ਠੀਕ ਕਿੰਨੇ ਕੁ ਵਜੇ ਟਾਈਮਿੰਗ ਹੈਗੀ ਆ ਸਵੇਰੇ ਓਪਨ ਦੀ ਠੀਕ ਹੈ ਠੀਕ ਹੈ ਓਕੇ ਮੈਮ ਥੈਂਕਿਊ